ਹੈਲੋ ਹਾਂਜੀ ਤੁਸੀਂ ਗਾਈਡ ਬੋਲ ਰਹੇ ਹੋ ਅਸੀਂ ਨਾ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਆਏ ਸੀ ਅਤੇ ਅਸੀਂ ਨਾਲ ਨਾਲ ਦੇ ਗੁਰਦੁਆਰੇ ਅਤੇ ਜਾਂ ਕੋਈ ਵੀ ਇੱਥੇ ਨੇੜੇ ਨੇੜੇ ਪਾਰਕ ਨੇ ਕੋਈ ਹੋਰ ਵੇਖਣ ਵਾਲੀਆਂ ਥਾਵਾਂ ਨੇ ਉਹਨਾਂ ਦੇ ਬਾਰੇ ਸਾਨੂੰ ਥੋੜ੍ਹਾ ਦੱਸੋ ਅਸੀਂ ਉਹ ਵਿਜਿਟ ਕਰਨਾ ਚਾਹੁੰਦੇ ਹਾਂ ਨੇੜੇ ਨੇੜੇ ਦੇ ਠੀਕ ਹੈ ਜੀ ਅਤੇ ਥੋੜ੍ਹਾ ਬਜਟ ਬਾਰੇ ਦੱਸੋਗੇ ਕਿ ਕਿੰਨਾਂ ਕੁ ਬਜਟ ਆਏਗਾ ਅਤੇ ਕਿੰਨਾਂ ਕੁ ਟਾਈਮ ਲੱਗ ਜਾਏਗਾ ਸਾਨੂੰ ਇੱਥੇ ਘੁੰਮਣ ਲਈ ਨਹੀਂ ਠੀਕ ਹੈ ਜੀ ਇਹ ਸਾਰਾ ਕੁਛ ਤਾਂ ਬਹੁਤ ਵਧੀਆ ਨਾਲ ਨਾਲ ਤੁਸੀਂ ਆਪਣਾ ਬਜਟ ਵੀ ਦੱਸ ਦਿੰਦੇ ਤਾਂ ਬਹੁਤ ਵਧੀਆ ਹੁੰਦਾ ਠੀਕ ਹੈ ਜੀ ਮੈਂ ਤੁਹਾਨੂੰ ਹੁਣੇ ਕੋਲ ਕਰਦੀ ਹਾਂ ਦੁਬਾਰਾ ਧੰਨਵਾਦ ਜੀ ਬਹੁਤ ਬਹੁਤ